ਜਦੋਂ ਮੈਂ ਅੱਠਵੀਂ ਕਲਾਸ 'ਚ ਪੜ੍ਹਦਾ ਸੀ ਤਾਂ ਉਸ ਸਮੇਂ ਮੈਂ ਇੱਕ ਪੇਂਟਿਗ ਆਪਣੇ ਡਰਾਇੰਗ ਟੀਚਰ ਸਰਦਾਰ ਤ੍ਰਿਲੋਚਨ ਸਿੰਘ ਜੀ ਨੂੰ ਦਿੱਤੀ ਸੀ ਉਹ ਡਰਾਇੰਗ ਜੋ ਮੈਂ ਬਣਾਈ ਗਈ ਸੀ ਮੇਰੇ ਵੱਲੋਂ ਪੇਟਿੰਗ ਉਸ ਵਿੱਚ ਪਹਾੜਾਂ ਦੇ ਵਿੱਚੋਂ ਜੋ ਸੂਰਜ ਦੀ ਸਵੇਰ ਹੁੰਦੀ ਦਿਖਾਈ ਦਿੱਤੀ ਸੀ ਅਤੇ ਥੱਲੇ ਇੱਕ ਛੋਟੀ ਜਿਹੀ ਝੌਪੜੀ ਬਣੀ ਹੋਈ ਸੀ ਅਤੇ ਉੱਥੇ ਨਾਲ ਹੀ ਪਾਣੀ ਦੀ ਨਦੀ ਵੀ ਵਗ ਰਹੀ ਸੀ ਜਦੋਂ ਮੈਂ ਉਹ ਪੇਂਟਿੰਗ ਆਪਣੇ ਮਾਸਟਰ ਜੀ ਨੂੰ ਦਿੱਤੀ ਤਾਂ ਉਹ ਬਹੁਤ ਜ਼ਿਆਦਾ ਖੁਸ਼ ਹੋਏ ਅਤੇ ਉਹਨਾਂ ਨੇ ਮੈਨੂੰ ਇਹ ਵੀ ਦੱਸਿਆ ਕਿ ਜੋ ਤੁਸੀਂ ਇਹ ਪੇਂਟਿੰਗ ਬਣਾਈ ਹੈ ਇਹ ਤੁਹਾਡੀ ਆਪਣੀ ਮਿਹਨਤ ਹੈ ਇਹ ਮੇਰੇ ਲਈ ਬਹੁਤ ਹੀ ਭਾਵਨਾਤਮਕ ਹੈ ਕਿਉਂਕਿ ਤੁਸੀਂ ਖੁਦ ਇਸ ਨੂੰ ਆਪਣੇ ਹੱਥਾਂ ਨਾਲ ਆਪਣੇ ਪੈੱਨ ਸਕੈਚ ਜਾਂ ਰਬੜ ਵਰਤ ਕੇ ਇਸ ਨੂੰ ਤੁਸੀਂ ਬਣਾਇਆ ਹੈ ਇਸ ਨੂੰ ਮੈਂ ਹਮੇਸ਼ਾਂ ਹੀ ਆਪਣੇ ਪਾਸ ਸੰਭਾਲ ਕੇ ਰੱਖਾਂਗਾ ਅਤੇ ਉਹ ਚੀਜ਼ ਮੈਨੂੰ ਅੱਜ ਤੱਕ ਵੀ ਯਾਦ ਹੈ